ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਪਠਾਨਕੋਟ ਤੋਂ ਬੋਲ ਰਹੀ ਹਾਂ ਹਾਂਜੀ ਮੈਂ ਤੁਹਾਨੂੰ ਪੰਜਾਬ ਦੇ ਇੱਕ ਬਹੁਤ ਵਧੀਆ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਬਜ਼ੁਰਗਾਂ ਦੀ ਦੇਖ ਰੇਖ ਸਮੱਸ ਸਮਾਜਿਕ ਸਹਾਇਤਾ ਅਤੇ ਸਮਾਨ ਬਾਰੇ ਦੱਸਣ ਜਾ ਰਹੀ ਹਾਂ ਵੈਸੇ ਤਾਂ ਸਾਡਾ ਪਠਾਨਕੋਟ ਦੇ ਸਾਰੇ ਲੋਕ ਬਹੁਤ ਵਧੀਆ ਹਨ ਸਾਰੇ ਮਿਲਜੁਲ ਕੇ ਅਤੇ ਸਭ ਦਾ ਆਦਰ ਸਨਮਾਨ ਕਰਦੇ ਰਹਿੰਦੇ ਹਨ ਬ ਬੱਚੇ ਵੱਡਿਆਂ ਦਾ ਅ ਆਦਰ ਸਨਮਾਨ ਕਰਦੇ ਹਨ ਬਜ਼ੁਰਗਾਂ ਦਾ ਕਹਿਣਾ ਮੰਨਦੇ ਹਨ ਅਤੇ ਉਹਨਾਂ ਦੀ ਬੜੀ ਹੀ ਸੇਵਾ ਵੀ ਕਰਦੇ ਹਨ ਨਾਲ ਸਾਡੇ ਪਠਾਨਕੋਟ ਦੇ ਲੋਕ ਤਾਂ ਸਮਾਜਿਕ ਸਹਾਇਤਾ ਵੀ ਬਹੁਤ ਚੰਗੇ ਤਰੀਕੇ ਨਾਲ ਦਿੰਦੇ ਹਨ ਬਜ਼ੁਰਗਾਂ ਨੂੰ ਬਾਕੀ ਸਾਡੇ ਪਠਾਨਕੋਟ ਕੋਈ ਵੀ ਬਜ਼ੁਰਗ ਅਕੇਲਾਪਣ ਦਾ ਕਦੇ ਸ਼ਿਕਾਰ ਨਹੀਂ ਹੁੰਦਾ ਕਿਉਂਕਿ ਇੱਥੇ ਦੇ ਲੋਕ ਆਪਣੇ ਬਜ਼ੁਰਗਾਂ ਨਾਲ ਆਪਣਾ ਸਮਾਂ ਬਤੀਤ ਕਰਦੇ ਹਨ ਜਿਸ ਨਾਲ ਉਹ ਹੋਰ ਵੀ ਬੜੇ ਖੁਸ਼ ਰਹਿੰਦੇ ਹਨ ਉਹਨਾਂ ਦੇ ਬਹੁਤ ਸਹਾਇਤਾ ਕਰਦੇ ਹਨ ਧੰਨਵਾਦ